ਹੈਲੋ ਹਾਂਜੀ ਸ਼ੱਸ਼ੀ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਮੈਂ ਐਜ ਏ ਗਾਈਡ ਤੁਹਾਨੂੰ ਚੁਣਿਆ ਹੈ ਕਿਉਂਕਿ ਮੈਂ ਨਾ ਅੰਮ੍ਰਿਤਸਰ ਪਹਿਲੀ ਵਾਰ ਆ ਰਹੀ ਹਾਂ ਅਤੇ ਮੈਨੂੰ ਇੱਥੇ ਤੁਹਾਡੀ ਜ਼ਰੂਰਤ ਹਰ ਪਲ ਹੈ ਕਿਉਂਕਿ ਮੈਂ ਪਹਿਲੀ ਵਾਰ ਅੰਮ੍ਰਿਤਸਰ ਦੀ ਯਾਤਰਾ 'ਤੇ ਆਈ ਹਾਂ ਅਤੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਮੱਥਾ ਟੇਕ ਕੇ ਦਰਬਾਰ ਸਾਹਿਬ ਮੇਰੇ ਮਨ ਕੀ ਮੈਂ ਤੁਹਾਡੇ ਤੋਂ ਪੁੱਛਾ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਜਦੋਂ ਕੋਈ ਖਰੀਦੋ ਫਰੋਖਤ ਕਰਨੀ ਹੈ ਕਿਹੜੇ ਕਿਹੜੇ ਬਾਜ਼ਾਰ ਹਨ ਜਿੱਥੇ ਮੈਂ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਜਿਹੜੀ ਖਰੀਦੋ ਫਰੋਖਤ ਕਰ ਸਕਾਂ ਦੇਖੋ ਜੀ ਤੁਸੀਂ ਮੈਨੂੰ ਜਿਵੇਂ ਪੰਜਾਬੀ ਜੁੱਤੀਆਂ ਅਤੇ ਫੁਲਕਾਰੀ ਦੇ ਸੂਟ ਜਿਹੜੇ ਕਿ ਅੰਮ੍ਰਿਤਸਰ ਬਹੁਤ ਮਸ਼ਹੂਰ ਹਨ ਫੁਲਕਾਰੀ ਦੇ ਸੂਟ ਫੁਲਕਾਰੀ ਦੀਆਂ ਚੁੰਨੀਆਂ ਅਤੇ ਪੰਜਾਬੀ ਜੁੱਤੀਆਂ ਵਾਲਾ ਬਾਜ਼ਾਰ ਤੁਸੀਂ ਮੈਨੂੰ ਉੱਥੇ ਲੈ ਕੇ ਚੱਲੋ ਤਾਂ ਕਿ ਮੈਂ ਉੱਥੇ ਆਪਣੀ ਖਰੀਦੋ ਫਰੋਖਤ ਕਰ ਸਕਾਂ ਅੱਛਾ ਜੀ ਠੀਕ ਹੈ ਜੀ ਹਾਂਜੀ

ਅਤੇ ਲੋਕ ਸ਼ਾਸਤਰੀ ਮਾਰਕੀਟ ਅਤੇ ਹਾਲ ਬਾਜ਼ਾਰ ਕਟੜਾ ਜੈਮਲ ਸਿੰਘ ਅਸੀਂ ਉਸ ਬਾਜ਼ਾਰ ਵਿੱਚ ਜਾਈਏ ਤਾਂ ਉੱਥੇ ਸਾਨੂੰ ਵਧੀਆ ਚੀਜ਼ਾਂ ਮਿਲ ਜਾਣਗੀਆਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਕੀ ਜਿਹੜੇ ਆਪਣੇ ਇਹ ਆਟੋ ਰਿਕਸ਼ਾ ਵਾਲੇ ਨੇ ਜੇ ਰਿਕਸ਼ਾ ਵਾਲੇ ਨੇ ਸਾਰੇ ਵਿਸ਼ਵਾਸਯੋਗ ਨੇ ਵਿਸ਼ਵਾਸ ਦੇ ਪਾਤਰ ਹਨ ਅਸੀਂ ਉਹਨਾਂ ਦੇ ਨਾਲ ਜਾ ਸਕਦੇ ਹਾਂ ਆਰਾਮ ਨਾਲ ਖਰੀਦੋ ਫਰੋਖਤ ਕਰਨ ਵਾਸਤੇ ਹਾਂ ਹਾਂ ਹਾਂ ਹਾਂ ਚਲੋ ਠੀਕ ਹੈ ਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਔਰ ਤੁਸੀਂ ਮੈਨੂੰ ਬਹੁਤ ਹੀ ਸੰਖੇਪ ਜਿਹੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫਿਰ ਮੈਂ ਤੁਹਾਨੂੰ ਕੰਟੈਕਟ ਕਰ ਲਵਾਂਗੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ